ਛੋਟੇ ਹੁੰਦੇ ਛੋਟੇ ਹੁੰਦੇ ਕਦੀ ਕਦਾਰ ਮਤਲਬ ਮੂਰਤੀ ਬਣਾਉਣ ਦਾ ਪਰਿਆਸ ਕੀਤਾ ਸੀ ਜੋ ਕਿ ਜਿਵੇਂ ਕਿ ਪਹਿਲਾਂ ਕਿ ਲੋਹੇ ਦਾ ਫਰੇਮ ਇਕੱਠਾ ਕਰਕੇ ਫਿਰ ਉਹਦੇ ਵਿੱਚ ਮਤਲਬ ਸੀਮਿੰਟ ਨਾਲ ਜਾਂ ਰੇ ਰੇਤ ਨਾਲ ਜੋ ਮੂਰਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਅਸੰਭਵ ਨਹੀਂ ਹੋ ਪਾਇਆ ਸੀ ਅਤੇ ਤਾਂ ਵੀ ਅਸੀਂ ਫਿਰ ਵੀ ਪ੍ਰੈਕਟਿਸ ਕਰਦੇ ਰਹਿੰਦੇ ਹੁੰਦੇ ਸੀ ਅਤੇ ਕਿਸੇ ਵੇ ਕਿਸੀ ਟਾਈਮ 'ਤੇ ਕਲੇ ਨਾਲ ਵੀ ਬਣਵਾਈ ਦੀ ਹੁੰਦੀ ਸੀ ਅਤੇ ਬਟ ਹੌਲੀ ਹੌਲੀ ਹੌਲੀ ਹੌਲੀ ਸਾਡਾ ਹੱਥ ਸਾਫ਼ ਹੁੰਦਾ ਜਾਂਦਾ ਰਿਹਾ ਪਰ ਫਿਰ ਵੀ ਅਸੀਂ ਥੋੜ੍ਹੀ ਬਹੁਤ ਮੂਰਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਅਸੀਂ ਉਹਦੇ 'ਚ ਸਫ਼ਲ ਰਹੇ ਸੀ ਤਾਂ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਸਾਡੇ ਪ੍ਰਥਾ ਵਿੱਚ ਮੂਰਤੀ ਬਣਾਉਣਾ ਜਾਂ ਨਾ ਬਣਾਉਣਾ ਅਸੰਭਵ ਨਹੀਂ ਹੈਗਾ ਪਰ ਫਿਰ ਵੀ ਅਸੀਂ ਥੋੜ੍ਹੀ ਬਹੁਤ ਕੋਸ਼ਿਸ਼ ਕਰਦੇ ਰਹਿੰਦੇ ਹਾਂ ਮੂਰਤੀਆਂ ਬਣਾਉਣ ਦੀ ਬਟ ਫਿਰ ਵੀ ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਕਰਕੇ ਸਾਡੇ 'ਚ ਵੈਸੇ ਪ੍ਰਥਾ ਨਹੀਂ ਹੈਗੀ ਕਿ ਅਸੀਂ ਮੂਰਤੀਆਂ ਬਣਾ ਕੇ ਉਹਨਾਂ ਦੀਆਂ ਪੂਜਾ ਕਰੀਏ ਬਟ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਚਲੋ ਥੋੜ੍ਹਾ ਬਹੁਤਾ ਥੋੜ੍ਹੀ ਬਹੁਤੀ ਚਲਦੀ ਰਹੇ ਪ੍ਰਥਾ ਇਹੀ ਬਹੁਤ ਕੁਝ